ਸਭ ਤੋਂ ਪਹਿਲਾਂ ਤਾਂ ਪ੍ਰਸਿੱਧ ਸੈਲਾਨੀ ਆਕਰ ਅਕਰਸ਼ਨ ਹੈ ਜੋ ਸੈਲਾਨੀਆਂ ਲਈ ਉਹ ਹੈ ਸਾਡਾ ਪੰਜਾਬ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਸਸ਼ੋਭਿਤ ਆ ਜਿੱਥੇ ਕਿ ਇਕੱਲੇ ਪੰਜਾਬ ਤੋਂ ਹੀ ਨਹੀਂ ਪੰਜਾਬੋਂ ਬਾਹਰੋਂ ਸਟੇਟ ਤੋਂ ਹੀ ਨਹੀਂ ਈਵਨ ਕਿ ਵਿਦੇਸ਼ਾਂ ਤੋਂ ਵੀ ਸੈਲਾਨੀ ਆਉਂਦੇ ਨੇ ਵਿਦੇਸ਼ਾਂ ਤੋਂ ਵੀ ਸੈਲਾਨੀ ਆ ਕਰਕੇ ਉੱਥੇ ਨਤਮਸਤਕ ਹੁੰਦੇ ਆ ਗੁਰੂ ਰਾਮਦਾਸ ਦੇ ਦਰਬਾਰ ਦੇ ਵਿੱਚ ਤਾਂ ਜਾਣੋ ਕਿ ਇੰਨਾ ਸਕੂਨ ਮਿਲਦਾ ਕਿ ਕੋਈ ਮਤਲਬ ਆਪਾਂ ਕਹਿ ਨਹੀਂ ਸਕਦੇ ਇੰਨਾ ਸਕੂਨ ਮਿਲਦਾ ਉਸ ਤੋਂ ਬਾਅਦ ਅਗਲੇ ਨੇ ਉੱਥੇ ਦਰਸ਼ਨ ਦੀਦਾਰੇ ਕੀਤੇ ਹੋਰ ਲੋਕਲ ਗੁਰਦੁਆਰੇ ਜਿੱਦਾਂ ਬਾਬਾ ਦੀਪ ਸਿੰਘ ਜੀ ਦਾ ਹੋ ਗਿਆ ਉਹਦੇ ਦੀਦਾਰੇ ਕੀਤੇ ਨਾਲ ਹੀ ਜਲਿਆਂ ਵਾਲਾ ਬਾਗ ਆ ਜਲਿਆਂ ਵਾਲੇ ਬਾਗ ਦੇ ਵਿੱਚ ਜਿੱਥੇ ਅੰਗਰੇਜ਼ ਜਰਨਲ ਡਾਇਰ ਨੇ ਸਾਕਾ ਕੀਤਾ ਸੀਗਾ ਉਹਦੇ ਦਰਸ਼ਨ ਕਰਨ ਉਪਰੰਤ ਸੰਗਤ ਹੈ ਜੋ ਸੈਲਾਨੀ ਨੇ ਨਾਲ ਹੀ ਸਾਡੇ ਫਿਰ ਇੱਕ ਦੇਸ਼ ਲੱਗਦਾ ਹੈਗਾ ਪਾਕਿਸਤਾਨ ਉਹਦਾ ਹੈ ਵਾਹਗਾ ਬੋਡਰ ਵਾਹਗਾ ਬੋਡਰ ਬੜਾ ਮਸ਼ਹੂਰ ਆ ਇੱਕ ਖਾਸ ਦਿਨ ਹੁੰਦਾ ਉਸ ਦਿਨ ਉੱਥੇ ਪਰੇਡ ਹੁੰਦੀ ਹੈ ਜੋ ਉਹਨੂੰ ਬਹੁਤ ਹੀ ਧਿਆਨ ਨਾਲ ਦੇਖਦੇ ਆ ਭਾਰਤ ਅਤੇ ਪਾਕਿਸਤਾਨ ਦੇ ਫੌਜੀ ਜਵਾਨਾਂ ਦੇ ਪਰੇਡ ਨੂੰ ਬੜੇ ਢੰਗ ਨਾਲ ਦੇਖਦੇ ਆ ਉਸ ਤੋਂ ਬਾਅਦ ਸਾਡੇ ਛੱਤ ਇੱਥੇ ਛੱਤਬੀੜ ਹੈਗਾ ਚਿੜੀਆਘਰ ਉਹਨੂੰ ਵੀ ਦੇਖਦੇ ਆ